ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਅੰਜਲੀ ਮੈਂ ਅੰਜਲੀ ਮੈਨੂੰ ਨਾ ਤੁਹਾਡੀ ਫਰੈਂਡ ਅਮਨ ਨੇ ਨੰਬਰ ਦਿੱਤਾ ਤੁਹਾਡਾ ਮੈਂ ਚੰਡੀਗੜ੍ਹ ਤੋਂ ਰਹਿਣ ਵਾਲੀ ਹਾਂ ਮੈਂ ਨਾ ਨਵਾਸ਼ਹਿਰ ਗੁਰਦੁਵਾਰਾ ਸਾਹਿਬ ਮੱਥਾ ਟੇਕਣਾ ਸੀਗਾ ਆਉਣਾ ਸੀ ਅੱਛਾ ਜੀ ਮੈਂ ਜੀ ਰਾਜਾ ਸਾਹਿਬ ਗੁਰਦੁਆਰੇ ਘੁੰਮਣ ਆਈ ਅੱਛਾ ਜੀ ਮੈਂ ਵੀ ਨਾ ਸੁੱਖ ਸੁਖੀ ਸੀਗੀ ਉਹ ਪੂਰੀ ਕਰਨੀ ਸੀਗੀ ਫਿਰ ਤਾਂ ਕਰਕੇ ਮੈਂ ਅਤੇ ਮੇਰੀ ਫੈਮਲੀ ਹੈ ਅਤੇ ਨਾਲ ਦੀ ਗੁਆਂਢੀ ਵੀ ਹੈ ਇੱਕ ਤਰੀਕ ਨੂੰ ਜਾਣਾ ਏ ਸਵੇਰੇ ਨੂੰ ਦਸ ਕੁ ਵਜੇ ਤੱਕ ਉਹ ਤੁਹਾਡੇ ਕੋਲ ਟਾਈਮ ਹੈਗਾ ਏ ਫ਼ਿਰ ਹਾਂਜੀ ਹਾਂਜੀ ਕੋਈ ਨਾ ਐਤਵਾਰ ਨੂੰ ਚੱਲਾਂਗੇ ਫਿਰ ਮੈਂ ਨਾ ਗੁਰਮਾਲਾ ਮੈਂ ਨਾ ਗੁਰਮਾਲਾ ਸੁੱਖ ਸੁੱਖੀ ਸੀਗੀ ਹੈ ਨਾ ਫਿਰ ਉਹ ਗੁਰਮਾਲਾ ਲੈਣਾ ਸੀ ਇਥੋਂ ਮਿਲਜੂੰਗੇ ਕਿ ਲੈ ਕੇ ਆਉਣਾ ਪੈਣਾ ਬਾਹਰੋਂ ਹੀ ਹਾਂਜੀ ਠੀਕ ਹੈ ਹਾਂਜੀ ਹਾਂਜੀ ਮੈਂ ਆਪਣੇ ਪਿੰਡੋ ਟੈਕਸੀ ਕਰਾਈ ਹੋਈ ਹੈ ਅਤੇ ਮੈਂ ਤੁਹਾਨੂੰ ਵੀ ਨਾਲੇ ਲੈ ਚੱਲੂਂਗੀ ਹਾਂਜੀ ਕੋਈ ਨਾ ਤੁਹਾਨੂੰ ਕੋਲ ਕਰਦੂੰਗੀ ਓਕੇ ਠੀਕ ਆ ਥੈਂਕ ਯੂ